ਡਿਜੀਟਲ ਕਲਾ ਮਨੁੱਖੀ ਮਨੁੱਖਾਂ ਦੁਆਰਾ ਬਣਾਈ ਕਲਾ ਤੋਂ ਸਾਫ ਤਾਂ ਹੋ ਸਕਦੀ ਹੈ ਪਰ ਮਨੁੱਖ ਜਿੰਨੀ ਗਹਿਰੀ ਨਹੀਂ ਹੋ ਸਕਦੀ ਕਿਉਂਕਿ ਮਨੁੱਖ ਨੇ ਆਪਣਾ ਆਲਾ ਦੁਆਲਾ ਵੇਖ ਕੇ ਬਹੁਤ ਕੁਝ ਨਵਾਂ ਪੁਰਾਣਾ ਸਿੱਖ ਕੇ ਚਿੱਤਰਕਾਰੀ ਕਰਨੀ ਹੁੰਦੀ ਹੈ ਮਨੁੱਖੀ ਜਜ਼ਬਾਤ ਮਨੁੱਖ ਦੁਆਰਾ ਬਣਾਈ ਪੇਟਿਗ ਵਿੱਚ ਹੀ ਉਜ ਉਜਾਗਰ ਹੋ ਸਕਦੇ ਹਨ ਜਦੋਂ ਕਿ ਆਧੁਨਿਕ ਢੰਗ ਨਾਲ ਕਈ ਵਾਰੀ ਅਸੀਂ ਆਪਣੇ ਜਜ਼ਬਾਤਾਂ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦੇ ਪਰ ਡਿਜੀਟਲ ਕਲਾ ਅੱਜ ਦੇ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ ਜਿਸ ਨਾਲ ਮਨੁੱਖ ਦਾ ਸਮਾਂ ਬਚਦਾ ਹੈ ਅਤੇ ਖਰਚ ਵੀ ਘੱਟ ਹੁੰਦਾ ਹੈ ਅੱਜ ਕੱਲ ਡਿਜੀਟਲ ਸੂਟ ਅੱਜ ਕੱਲ ਸੂਟਾਂ 'ਤੇ ਡਿਜ਼ਾਇਨ ਕੰਪਿਊਟਰ ਵਿੱਚ ਤਿਆਰ ਕੀਤੇ ਜਾਂਦੇ ਹਨ ਅਤੇ ਕੰਪਿਊਟਰ ਦੁਆਰਾ ਹੀ ਮਸ਼ੀਨੀ ਕਢਾਈ ਤਿਆਰ ਕੀਤੀ ਜਾਂਦੀ ਹੈ ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਪਰ ਇਹ ਕਢਾਈ ਵਿੱਚ ਹੱਥ ਜਿੰਨੀ ਸਫਾਈ ਨਹੀਂ ਹੁੰਦੀ ਜਿੰਨੀ ਆਪਾਂ ਆਪਣੇ ਹੱਥਾਂ ਨਾਲ ਕਰ ਲੈਂਦੇ ਹਾਂ ਅੱਜ ਕੱਲ ਸਾਰੇ ਕੰਮ ਜ਼ਿਆਦਾਤਰ ਡਿਜਟਲ ਵਿਧੀ ਰਾਹੀਂ ਕੀਤੇ ਜਾਂਦੇ ਹਨ ਪਰ ਮੈਨੂੰ ਜ਼ਿਆਦਾ ਕੰਮ ਆਪਣੇ ਹੱਥੀਂ ਹੀ ਕਰਨਾ ਪਸੰਦ ਹੈ ਡਿਜੀਟਲ ਵਿਧੀ ਨਾਲੋਂ ਮੈਨੂੰ ਆਪਣੇ ਹੱਥਾਂ ਦੀ ਸਫਾਈ ਵਧੀਆ ਲੱਗਦੀ ਹੈ ਮੈਂ ਆਪਣੇ ਹੱਥਾਂ ਨਾਲ ਸਵੈਟਰ ਟੋਪੀਆਂ ਕੋਟੀਆਂ ਕਢਾਈਆਂ ਕੱਢਦੀ ਹਾਂ ਇਹਨਾਂ ਵਿੱਚ ਹੱਥਾਂ ਰਾਹੀਂ ਸਫਾਈ ਵੀ ਬਹੁਤ ਆਉਂਦੀ ਹੈ ਅਤੇ ਸਭ ਨੂੰ ਪਸੰਦ ਵੀ ਬਹੁਤ ਹੁੰਦੇ ਹਨ